ਅੱਜ ਕੱਲ੍ਹ ਹਰ ਵਿਅਕਤੀ ਆਪਣੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ ਅਤੇ ਉਹ ਹਮੇਸ਼ਾ ਆਪਣੇ ਭਾਰ ਨੂੰ ਘਟਾਉਣ ਦੇ ਬਾਰੇ ਸੋਚਦਾ ਹੈ ਪਰ ਇਸ ਦੇ ਵਿੱਚ ਪ੍ਰਸਿੱਧ ਘਰੇਲੂ ਉਪਚਾਰ ਪੁੱਛੇ ਗਏ ਹਨ ਜਿਸ ਦੇ ਨਾਲ ਇੱਕ ਵਿਅਕਤੀ ਦਾ ਭਾਰ ਵੱਧ ਸਕੇ ਤਾਂ ਸਭ ਤੋਂ ਪਹਿਲਾਂ ਘਰੇਲੂ ਉਪਚਾਰ ਇਹ ਹੈ ਕਿ ਜੇਕਰ ਕੋਈ ਵਿਅਕਤੀ ਮਾਸਾਹਾਰੀ ਹੈ ਤਾਂ ਉਹ ਮਾਸ ਦਾ ਸੇਵਨ ਕਰਕੇ ਆਪਣੇ ਭਾਰ ਨੂੰ ਵਧਾ ਸਕਦਾ ਹੈ ਹੁਣ ਮਾਸ ਦੇ ਸੇਵਨ ਦੇ ਵਿੱਚ ਜਿਵੇਂ ਕਿ ਮੁਰਗਾ ਮੱਛੀ ਇਹ ਚੀਜ਼ਾਂ ਦਾ ਮਾਸ ਖਾ ਕੇ ਬੰਦਾ ਆਪਣੇ ਭਾਰ ਨੂੰ ਵਧਾ ਸਕਦਾ ਹੈ ਅਤੇ ਦੂਜਾ ਨੁਸਖਾ ਇਹ ਹੈ ਕਿ ਰੁਜ਼ਗਾਰ ਇਹ ਹੈ ਕਿ ਘਰ ਦਾ ਬਣਿਆ ਹੋਇਆ ਖਾਣਾ ਖਾਓ ਜਿਵੇਂ ਕਿ ਪਿੰਡਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਦੁੱਧ ਲੱਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਤਾਂ ਵਿਅਕਤੀ ਦੁੱਧ ਲੱਸੀ ਘਿਓ ਇਹਨਾਂ ਚੀਜ਼ਾਂ ਦਾ ਸੇਵਨ ਭਰਪੂਰ ਮਾਤਰਾ ਦੇ ਵਿੱਚ ਕਰਕੇ ਆਪਣੇ ਭਾਰ ਨੂੰ ਵਧਾ ਸਕਦਾ ਹੈ ਅਤੇ ਵਿਅਕਤੀ ਪਨੀਰ ਨੂੰ ਖਾ ਕੇ ਵੀ ਆਪਣੇ ਭਾਰ ਨੂੰ ਵਧਾ ਸਕਦਾ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬੰਦਾ ਹਾਈ ਪ੍ਰੋਟੀਨ ਚੀਜ਼ਾਂ ਨੂੰ ਖਾ ਕੇ ਆਪਣੇ ਭਾਰ ਨੂੰ ਵਧਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਹਰੇਕ ਘਰ ਦੇ ਵਿੱਚ ਜਿਵੇਂ ਕਿ ਘਰ ਦਾ ਖੋਇਆ ਹੋ ਗਿਆ ਪੰਜੀਰੀ ਹੋ ਗਈ ਇਹਨਾਂ ਚੀਜ਼ਾਂ ਨੂੰ ਖਾ ਕੇ ਵੀ ਬੰਦਾ ਆਪਣੇ ਭਾਰ ਨੂੰ ਵਧਾ ਸਕਦਾ ਹੈ